ਨਹੀਂ ਡਾਇਰੀਆਂ ਜਾਂ ਰਸਾਲੇ ਤਾਂ ਨਹੀਂ ਲਿਖਦੇ ਹੈਗੇ ਬਟ ਹਾਂ ਅ ਸਟੋਰੀ ਰਾਈਟਿੰਗ ਲਿਖਣ ਦਾ ਸ਼ੌਕ ਹੈ ਔਰ ਸ਼ੇਅਰੋ ਸ਼ਾਇਰੀ ਲਿਖਣ ਦਾ ਸ਼ੌਕ ਹੈ ਉਹ ਜ਼ਿਆਦਾਤਰ ਹਿੰਦੀ 'ਚ ਹੁੰਦੀ ਹੈ ਜਾਂ ਪੰਜਾਬੀ ਦੇ ਵਿੱਚ ਹੁੰਦੀ ਹੈ ਪ੍ਰੇਰਿਤ ਕਹਿ ਸਕਦੇ ਹਾਂ ਕਿ ਹਾਂ ਬੁੱਕਸ ਪੜ੍ਹਨ ਦਾ ਸ਼ੌਂਕ ਹੈ ਬੁੱਕਸ ਪੜ੍ਹਦੇ ਰਹੀਦਾ ਉਸ ਤੋਂ ਬਾਅਦ ਫੋਕਸ ਰਹਿਣ ਦੇ ਲਈ ਮੈਡੀਟੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਜਿੰਨਾ ਪੜ੍ਹਦੇ ਹਾਂ ਉਨਾ ਹੀ ਲਿਖਣ ਦੇ ਲਈ ਪ੍ਰੇਰਿਤ ਹੁੰਦੇ ਹਾਂ ਕਿ ਹਾਂ ਸਾਨੂੰ ਵੀ ਕੁਛ ਲਿਖਣਾ ਚਾਹੀਦਾ ਆਪਣੇ ਜ਼ਜ਼ਬਾਤ ਜਿਹੜੇ ਨੇ ਸਮਟਾਈਮਸ ਜਿਹੜੇ ਹੈਗੇ ਆ ਜੋ ਇਸ਼ੂਜ ਚੱਲ ਰਹੇ ਹੋਣ ਉਹਨਾਂ ਦੇ ਉੱਪਰ ਲਿਖਣਾ ਅੱਛਾ ਲੱਗਦਾ ਤਾਂ ਕਿ ਲੋਕੀਂ ਅਵੇਅਰ ਹੋਣ ਉਸ ਚੀਜ਼ ਬਾਰੇ ਅਤੇ ਬਸ ਇਹੀ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਥੋਟਸ ਲਿਖੋਂਗੇ ਨਹੀਂ ਉਦੋਂ ਤੱਕ ਲੋਕਾਂ ਨੂੰ ਕਿੱਦਾ ਪਤਾ ਚੱਲੇਗਾ ਕਿ ਹਾਂ ਇਸ ਆਪਣੇ ਵਿਚਾਰ ਵਿਮਸ਼ ਜਿਹੜੇ ਨੇ ਉਹ ਕਰਦੇ ਰਹੀਦਾ ਹੋਰ ਤਾਂ ਕੁਛ ਨਹੀਂ ਹੈ